ਹਾਂਜੀ ਅਸੀਂ ਆਪਣੇ ਰੋਜ਼ਾਨਾ ਸੋਸ਼ਲ ਮੀਡੀਆ ਪਲੇਟਫੋਰਮਾਂ ਦੀ ਬਹੁਤ ਵਰਤੋਂ ਕਰਦੇ ਹਾਂ ਅੱਜ ਕੱਲ੍ਹ ਹਰੇਕ ਵਿਅਕਤੀ ਕੋਲ ਫ਼ੋਨ ਹੈ ਜੋ ਕਿ ਹਰ ਬੰਦਾ ਪੂਰੇ ਵਿਸ਼ਵ ਵਿੱਚ ਸੋਸ਼ਲ ਮੀਡੀਆ ਐਪ ਦੀ ਵਰਤੋਂ ਕਰਦਾ ਹੈ ਜੋ ਕਿ ਅੱਜ ਕੱਲ੍ਹ ਆਮ ਹੋ ਗਿਆ ਹੈ ਅਤੇ ਮੈਂ ਆਪਣੇ ਅਨੁਸਾਰ ਦੱਸ ਸਕਦਾ ਹਾਂ ਕਿ ਮੈਂ ਵਟਸਐਪ ਫੇਸਬੁੱਕ ਅਤੇ ਯੂਟਿਊਬ ਦੀ ਵਰਤੋਂ ਕਰਦਾ ਹਾਂ ਕਿਉਂਕਿ ਵਟਸਐਪ ਸਾਰਿਆਂ ਕੋਲ ਹੈ ਵਟਸਐਪ ਦੇ ਜ਼ਰੀਏ ਅਸੀਂ ਹਰ ਇੱਕ ਚੀਜ਼ ਨੂੰ ਸ਼ੇਅਰ ਕਰ ਸਕਦੇ ਹਾਂ ਅਤੇ ਫੇਸਬੁੱਕ ਮੈਂ ਇਸ ਕਰਕੇ ਯੂਜ ਕਰਦਾ ਹਾਂ ਵੀ ਫੇਸਬੁੱਕ ਨੇ ਸਾਨੂੰ ਐਨਾ ਇੰਪਰੂਵ ਕੀਤਾ ਹੈ ਕਿ ਫੇਸਬੁੱਕ 'ਤੇ ਅਸੀਂ ਜ਼ਿਆਦਾਤਰ ਨਿਊਜ਼ਾਂ ਵਗੈਰਾ ਦੇਖ ਸਕਦੇ ਹਾਂ ਅਤੇ ਯੂਟਿਊਬ 'ਤੇ ਅੱਜ ਕੱਲ੍ਹ ਹਰੇਕ ਚੀਜ਼ ਹੁੰਦੀ ਹੈ ਜਿਸ ਨੇ ਕਿ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ ਹਰ ਚੀਜ਼ ਦਾ ਹੱਲ ਯੂਟਿਊਬ 'ਤੇ ਉਪਲਬਧ ਹੈ ਜੋ ਕਿ ਮਨੁੱਖ ਲਈ ਬਹੁਤ ਸਹਾਈ ਹੋਇਆ ਹੈ